ਭਾਰਤ ਵਿੱਚ ਮਸ਼ਹੂਰ ਨਾਚ ਸ਼ੈਲੀਆਂ ਤਾਂ ਬਹੁਤ ਹਨ ਪਰ ਇਹਨਾਂ ਵਿੱਚੋਂ ਇੱਕ ਭਾਰਤਨਾਟਿਆਮ ਅਤੇ ਨੌਰਥ ਇੰਡੀਆ ਦੇ ਵਿੱਚ ਹੈਗੀ ਜੇ ਕੱਥਕ ਅਤੇ ਸਾਡੇ ਅਤੇ ਪੰਜਾਬ ਵਿੱਚ ਗਿੱਧਾ ਅਤੇ ਭੰਗੜਾ ਸਾਰੇ ਪਸੰਦ ਕਰਦੇ ਆ ਸਾਡਾ ਲੋਕ ਨਾਚ ਵੀ ਇਹੀ ਆ ਅਤੇ ਜਿਹੜਾ ਹੈਗਾ ਵਾ ਡਾਂਸਰ ਦੀ ਗੱਲ ਕਰੀਏ ਤਾਂ ਡਾਂਸਰ ਪ੍ਰਭੂ ਦੇਵਾ ਜਿਹੜਾ ਵਾ ਉਹਦਾ ਡਾਂਸ ਜਿਹੜਾ ਵਾ ਦੁਨੀਆ ਪਸੰਦ ਕਰਦੀ ਆ ਜੋ ਕਿ ਇੱਕ ਬੋਲੀਬੁੱਡ ਦਾ ਮਸ਼ਹੂਰ ਡਾਂਸਰ ਹੈ ਜਿਹਨੇ ਕਿ ਸਾਉਥ ਇੰਡੀਆ ਦੀਆਂ ਫ਼ਿਲਮਾ ਦੇ ਵਿਚ ਵੀ ਚੰਗਾ ਆਪਣਾ ਨਾਂ ਬਣਾਇਆ ਵਾ ਸਾਰੀ ਦੁਨੀਆ ਹੀ ਉਹਨੂੰ ਜਾਣਦੀ ਆ ਅਤੇ ਸਾਡਾ ਤਾਂ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਭੰਗੜਾ ਅਤੇ ਗਿੱਧਾ ਹੀ ਹੈ ਜੀ ਸ਼ੁਕਰੀਆ